ਪੰਜਾਬੀ ਭਾਸ਼ਾ ਨੇ ਸਾਡੇ ਸੱਭਿਆਚਾਰ ਨੂੰ ਵੱਖਰੀ ਪਹਿਛਾਣ ਦਿੱਤੀ ਹੈ ਅਤੇ ਬਹੁਤ ਹੀ ਵਧੀਆ ਪ੍ਰਭਾਵ ਪਾਇਆ ਸਾਰੇ ਲੋਕਾਂ ਦੇ ਵਿੱਚ ਕਿਉਂਕਿ ਹੁਣ ਸਾਡੀ ਮਾਂ ਬੋਲੀ ਪੰਜਾਬੀ ਹੋਣ ਕਾਰਣ ਇੱਥੇ ਦੇ ਲੋਕਾਂ ਨੂੰ ਦੂਜੀਆਂ ਭਾਸ਼ਾਵਾਂ ਸਮਝਣੀਆਂ ਅਤੇ ਬੋਲਣੀਆਂ ਬੜੀਆਂ ਔਖੀਆਂ ਲੱਗਦੀਆਂ ਬੋਲ ਲੈਂਦੇ ਆ ਸਮਝ ਵੀ ਲੈਂਦੇ ਆ ਬਟ ਜਿਹੜੀ ਮੇਨ ਪ੍ਰੋਬਲਮ ਇਹ ਆਉਂਦੀ ਹੈ ਕਿ ਜਿਹੜਾ ਆਪਾਂ ਅੰਦਰੋਂ ਆਪਣੀ ਜਿਹੜੀ ਫੀਲਿੰਗਸ ਨੇ ਜਿਹੜੇ ਆਪਣੀਆਂ ਇੱਛਾਵਾਂ ਨੇ ਉਹਨੂੰ ਆਪਾਂ ਕਿਵੇਂ ਪ੍ਰਗਟ ਕਰ ਸਕਦੇ ਹਾਂ ਆਪਾਂ ਕਿਵੇਂ ਲੋਕਾਂ ਨੂੰ ਸਮਝਾ ਸਕਦੇ ਹਾਂ ਅਤੇ ਇਸ ਕਰਕੇ ਜਿਹੜੇ ਲੋਕ ਨੇ ਇਸ ਗੱਲ ਨੂੰ ਸਮਝਦੇ ਹਾਂ ਅਤੇ ਜਿਹੜੀ ਪੰਜਾਬੀ ਭਾਸ਼ਾ ਹੈ ਸੌਖੀ ਵੀ ਹੈ ਬਹੁਤ ਅੱਛੀ ਵੀ ਹੈ ਬਹੁਤ ਵਧੀਆ ਹੈ ਅਤੇ ਉਹ ਘੈਂਟ ਜੀ ਭਾਸ਼ਾ ਹੈ ਪੰਜਾਬੀ ਇਹਦੇ ਵਿੱਚ ਹਰ ਚੀਜ਼ ਨੂੰ ਬੜੇ ਮਤਲਬ ਵਧੀਆ ਢੰਗ ਨਾਲ ਦਿੱਤਾ ਜਾਂਦਾ ਹੈ ਜੇ ਇਹ ਹੀ ਮਤਲਬ ਕਹਿ ਲਓ ਕਿ ਆਪਾਂ ਕਿਸੇ ਨੂੰ ਹਾਲ ਚਾਲ ਹੀ ਪੁੱਛਣਾ ਹੋਵੇ ਭਰਾ ਕਿਵੇਂ ਆਂ ਤੂੰ ਕੀ ਹਾਲ ਹੈ ਤੇਰਾ ਸਭ ਠੀਕ ਹੈ ਮਤਲਬ ਅੱਧੀ ਗੱਲ ਤਾਂ ਬੰਦੇ ਨੂੰ ਵੈਸੇ ਹੀ ਲੱਗਦਾ ਕਿ ਮੈਂ ਠੀਕ ਹੋ ਗਿਆ ਜੀ ਉਹਦੀ ਗੱਲਬਾਤ ਤੋਂ ਹੀ ਜੇ ਇਹ ਹੀ ਕਿਸੇ ਹੋਰ ਭਾਸ਼ਾ ਵਿੱਚ ਪੁੱਛਿਆ ਜਾਵੇ ਤਾਂ ਸ਼ਾਇਦ ਇੰਨੇ ਉਹਦੇ ਵਿੱਚ ਤਾਕਤ ਨਾ ਹੋਵੇ ਇੰਨੇ ਉਹ ਸ਼ਬਦਾਂ ਦੇ ਵਿੱਚ ਪਾਵਰ ਨਾ ਹੋਵੇ ਬਟ ਜਿੱਦਾਂ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਕਹਿ ਲਓ ਕਿ ਜ਼ਬਰਦਸਤ ਭਾਸ਼ਾ ਹੈ ਘੈਂਟ ਜਿਹੀ ਭਾਸ਼ਾ ਹੈ ਅਤੇ ਇਹਨੂੰ ਸਮਝਣਾ ਬਹੁਤ ਹੀ ਵਧੀਆ ਅਤੇ ਅੱਜ ਦੇ ਸਮੇਂ ਵਿੱਚ ਮੈਨੂੰ ਲੱਗਦਾ ਪੂਰੇ ਦੁਨੀਆ ਵਿੱਚ ਪੰਜਾਬੀ ਭਾਸ਼ਾ ਬਹੁਤ ਜ਼ਿਆਦਾ ਮਤਲਬ ਕਿ ਲੋਕਪ੍ਰਿਅ ਹੋ ਰਹੀ ਹੈ ਸਾਡੇ ਸਿੰਗਰਾਂ ਤੋਂ ਥਰੂ ਸਾਡੇ ਮਤਲਬ ਜਿੰਨੇ ਵੀ ਸਾਡੇ ਵੱਖਰੇ ਵੱਖਰੇ ਤਰ੍ਹਾਂ ਦੇ ਫਿਲਮੀ ਹੋ ਗਏ ਜਾਂ ਗਾਣੇ ਹੋ ਗਏ ਇਹਨਾਂ ਕਰਕੇ ਸਾਡਾ ਜਿਹੜਾ ਪੰਜਾਬੀ ਭਾਸ਼ਾ ਹੈ ਬਹੁਤ ਜ਼ਿਆਦਾ ਫੇਮਸ ਹੋ ਰਿਹਾ ਹੈ